ਹੈਲੋ ਸਤਿ ਸ਼੍ਰੀ ਅਕਾਲ ਮੇਰਾ ਨਾਮ ਨਿਸ਼ੂ ਹੈ ਕੀ ਮੇਰੀ ਗੱਲ ਗੋਪਾਲ ਸਵੀਟਸ ਵਿੱਚ ਹੋ ਰਹੀ ਹੈ ਮੈਂ ਆਪਣੀ ਇੱਕ ਡਿਸ਼ ਔਡਰ ਕਰਵਾਉਣੀ ਸੀ ਛੋਲੇ ਭਟੂਰੇ ਅਗਰ ਉਪਲਬਧ ਹੈ ਤਾਂ ਮੈਨੂੰ ਪੰਜ ਪਲੇਟ ਔਡਰ ਕੀਤੀ ਜਾਵੇ ਅਤੇ ਮੈਂ ਪੈਸੇ ਤੁਹਾਨੂੰ ਕੈਸ਼ ਔਨ ਡਿਲੀਵਰੀ 'ਤੇ ਦੇ ਦੇਵਾਂਗੀ ਅਤੇ ਧਿਆਨ ਦੀ ਗੱਲ ਇਹ ਹੋਣੀ ਚਾਹੀਦੀ ਕਿ ਘੱਟ ਮਸਾਲੇਦਾਰ ਹੋਣਾ ਚਾਹੀਦਾ ਹੈ ਮੇਰੇ ਰਿਸ਼ਤੇਦਾਰ ਘਰ ਆਉਣ ਵਾਲਿਆਂ ਨੂੰ ਘੱਟ ਮਸਾਲੇਦਾਰ ਖਾਣਾ ਪਸੰਦ ਕਰਦੇ ਹਨ ਧੰਨਵਾਦ